ਨਿਊਯਾਰਕ ਇਟਲੀ ਪੈਰਿਸ ਰੋਮ ਫਰਾਂਸ ਲੰਡਨ ਇਟਲੀ ਇੰਗਲੈਂਡ ਕੈਲੀਫੋਰਨੀਆ ਵੇਟੀਸੰ ਸਿਟੀ ਸਨਫਰਾਂਸਿਸਕੋ ਇੰਡੀਆਨਾ ਬਰਸੀਲੋਨਾ ਸਪੇਨ ਕੈਲੀਫੋਰਨੀਆ ਡੈਨਮਾਰਕ ਰਸ਼ੀਆ ਚਾਈਨਾ ਬੈਰਿਨ ਵਾਲ ਮਾਊਂਟ ਖਿਲਮਿਨਜਾਰੋ ਟਾਵਰ ਬ੍ਰਿਜ ਤਾਜ ਮਹਿਲ ਪਿਰਾਮਿਡਸ ਓਫ ਗ ਗਾਇਜਾ ਮਾਊਂਟ ਐਵਰੈਸਟ ਕੈਪੀਟਲ ਹਿਲ ਬੁਰਜ ਅਲ ਅਰਬ ਵਿਲਸ ਟਾਵਰ ਐਕਰੋਪੋਲਿਸ ਟਰੇਵੀ ਫਾਊਂਟੇਨ ਲੋਵਰੇ ਮਿਊਜੀਅਮ ਬੁਕਿੰਗਕਮ ਪੈਲਸ ਦ ਵਾਈਟ ਹਾਊਸ ਵਰਸਲੀਜ